ਹਾਂ ਮੇਰਾ ਪਰਿਵਾਰ ਮੇਰੇ ਸ਼ੌਂਕ ਪੂਰੇ ਕਰਨ ਵਿੱਚ ਮੇਰਾ ਪੂਰਾ ਸਮਰਥਨ ਕਰਦਾ ਉਹਨਾਂ ਨੇ ਪਹਿਲਾਂ ਮੈਨੂੰ ਪੜ੍ਹਾਇਆ ਲਿਖਿਆ ਮੈਂ ਜਿਹੜੇ ਜੋ ਕੰਮ ਕਰਨਾ ਚਾਹੁੰਦੀ ਸੀ ਉਹਦੇ ਲਈ ਮੇਰੀ ਨੂੰ ਸਟਡੀ ਕਰਵਾਈ ਉਹਦੇ ਲਈ ਮੇਰੀ ਫੀਸ ਭਰੀਆਂ ਅਤੇ ਹੁਣ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ ਉਹ ਮੇਰੇ ਨਾਲ ਹਰ ਜਗ੍ਹਾ 'ਤੇ ਜਾਂਦੇ ਹੈ ਮੇਰੇ ਬਾਰੇ ਪੁੱਛਦੇ ਆ ਵੀ ਇਹ ਕੰਮ ਅਸੀਂ ਕਿਵੇਂ ਕਰ ਸਕਦੇ ਹਾਂ ਤਾਂ ਉਹ ਮੇਰੇ ਲਈ ਹਰ ਹਰ ਇੱਕ ਚੀਜ਼ ਕਰਦੇ ਆ ਜਿਹੜੀ ਕਿ ਕਰਨੀ ਚਾਹੀਦੀ ਹੈ ਅਤੇ ਮੈਂ ਅਗਰ ਕੁਛ ਵੀ ਉਹਨਾਂ ਨੂੰ ਕਹਿੰਦੀ ਹਾਂ ਵੀ ਮੈਂ ਇਹ ਚੀਜ਼ ਕਰਨੀ ਆ ਤਾਂ ਉਹ ਹਰੇਕ ਚੀਜ਼ ਨਾਲ ਸਹਿਮਤ ਹੁੰਦੇ ਆ ਕਦੇ ਵੀ ਮੈਨੂੰ ਮਨਾ ਨਹੀਂ ਕਰਦੇ ਉਹ ਮੇਰੇ ਲਈ ਹਰੇਕ ਚੀਜ਼ ਤਿਆਰ ਰੱਖਦੇ ਆ ਜਿਵੇਂ ਕਿ ਜੇ ਮੈਂ ਪੈਸੇ ਲਈ ਕਹਿ ਦਵਾਂ ਤਾਂ ਮੇਰੀਆਂ ਫੀਸਾਂ ਸਭ ਤੋਂ ਪਹਿਲਾਂ ਭਰੀਆਂ ਜਾਂਦੀਆਂ ਜਾਂ ਕੁਛ ਹੋਰ ਤਾਂ ਉਹ ਹਰ ਚੀਜ਼ ਲਈ ਹਾਂ ਕਰਦੇ ਆ ਕਦੇ ਵੀ ਕਿਸੇ ਚੀਜ਼ ਲਈ ਮਨਾ ਨਹੀਂ ਕਰਦੇ ਅਤੇ ਉਹ ਮੇਰਾ ਪੂਰਾ ਪੂਰਾ ਸਮਰਥਨ ਕਰਦੇ ਆ ਮੇਰੇ ਪ ਮੇਰੇ ਫੈਮਲੀ ਵਿੱਚ ਮੇਰੇ ਮੰਮਾ ਪਾਪਾ ਮੇਰੀ ਭੈਣ ਭਰਾ ਹਰ ਮੈਨੂੰ ਹਰੇਕ ਚੀਜ਼ ਲਈ ਸਪੋਰਟ ਕਰ ਰਹੇ ਆ ਕਦੇ ਵੀ ਕੋਈ ਚੀਜ਼ ਤੋਂ ਮਨਾ ਨਹੀਂ ਕਰਦੇ ਮੈਂ ਜਿੱਥੇ ਵੀ ਜਾਣਾ ਹੁੰਦਾ ਮੇਰੇ ਲਈ ਹਰ ਚੀਜ਼ ਪਤਾ ਕਰਨ ਜਾਂਦੇ ਆ ਨਾਲ ਭਾਵੇਂ ਉਹ ਕਾਲਜ ਹੋਵੇ ਜਾਂ ਕੁਛ ਵੀ ਮੇਰੇ ਨਾਲ ਮੈਨੂੰ ਮੇਰੇ ਫਰੈਂਡ ਸਰਕਲ 'ਚ ਵੀ ਹਮੇਸ਼ਾਂ ਭੇਜਦੇ ਆ ਤਾਂ ਉਹ ਕਦੇ ਵੀ ਮੈਨੂੰ ਕੋਈ ਚੀਜ਼ ਤੋਂ ਮਨ੍ਹਾ ਨਹੀਂ ਕਰਦੇ ਅਤੇ ਕਹਿੰਦੇ ਕਿ ਜੋ ਤੂੰ ਕਰਨਾ ਚਾਹੁੰਦੀ ਹੈ ਉਹ ਤੂੰ ਕਰ ਸਕਦੀ ਹੈ ਅਤੇ ਇਸ ਕਰਕੇ ਉਹ ਮੇਰਾ ਪੂਰਾ ਪੂਰਾ ਸਮਰਥਨ ਕਰਦੇ ਆ ਅਤੇ ਉਹਨਾਂ ਨੇ ਮੈਨੂੰ ਟੀ ਮੇਰੇ ਟੀਚਰ ਬਣਨ ਦੇ ਸੁਪਨੇ ਵਿੱਚ ਵੀ ਪੂਰਾ ਸਾਥ ਦਿੱਤਾ ਮੈਨੂੰ ਬੀਐਡ ਵਗੈਰਾ ਕਰਵਾਈ ਮੇਰੀਆਂ ਫੀਸਿਸ ਭਰੀਆਂ ਭਰੀਆਂ ਹਰ ਚੀਜ਼ ਵਿੱਚ ਮੈਨੂੰ ਸਪੋਰਟ ਕੀਤਾ